ਪੁਰਾਣੇ ਸਮਿਆਂ ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਖੂਹ ਹੁੰਦੇ ਸਨ ਅੱਜ ਕੱਲ੍ਹ ਤਾਂ ਕੋਈ ਵੀ ਖੂਹ ਨਹੀਂ ਰਿਹਾ ਜਿਵੇਂ ਕਿ

ਮੋਟਰ ਦੇ ਨਾਲ ਬਹੁਤ ਸੌਖੀ ਹੈ ਬਾਲਟੀਆਂ ਨਾਲ ਬਹੁਤ ਔਖੀ ਹੁੰਦੀ ਸੀ ਕਿ ਅਤੇ ਜਿਵੇਂ ਸੀਮੈਂਟ ਰੇਤਾ ਬਜਰੀ ਰਲਾਉਣਾ ਇਹ ਵੀ ਸਾਨੂੰ ਬਾਲਟੀਆਂ ਨਾਲ ਔਖਾ ਸੀ ਬਿਜਲੀ ਵਾਲੀ ਮੋਟਰ ਦੇ ਨਾਲ ਬਹੁਤ ਸੌਖਾ ਹੋ ਗਿਆ ਹੈ ਅਤੇ ਜਿਵੇਂ ਸਾਨੂੰ ਸਬਜ਼ੀਆਂ ਨੂੰ ਗਾਰਡਨ ਵਿੱਚ ਪਾਣੀ ਦੇਣਾ ਸਬਜ਼ੀਆਂ ਨੂੰ ਪੌਦਿਆਂ ਨੂੰ ਬਹੁਤ ਵਧੀਆ ਮੋਟਰ ਦੇ ਨਾਲ ਸਾਨੂੰ ਸੁਖ ਹੈ ਅਤੇ ਜਿਵੇਂ ਦੂਜੀ ਤੀਜੀ ਮੰਜ਼ਿਲ 'ਤੇ ਪਾਣੀ ਲੈ ਕੇ ਜਾਣਾ ਇਹ ਵੀ ਸਾਨੂੰ ਸੌਖਾ ਹੋ ਗਿਆ ਹੈ ਅਤੇ ਜਿਵੇਂ ਵੈਸੇ ਪਾਣੀ ਚੜ੍ਹਾਉਣਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਬਿਜਲੀ ਵਾਲੀ ਮੋਟਰ ਦੇ ਨਾਲ ਸਾਨੂੰ ਪਾਣੀ ਸੌਖਾ ਹੋ ਹੈ ਜਿਵੇਂ ਅਸੀਂ ਇਸ ਦੇ ਨਾਲ ਦੂਰ ਨੇੜੇ ਪਾਣੀ ਲੈ ਕੇ ਜਾਣਾ ਉਹ ਵੀ ਸਾਨੂੰ ਸੌਖਾ ਜੇ ਅਸੀਂ

ਸਾਨੂੰ ਬਿਜਲੀ ਵਾਲੀ ਮੋਟਰ ਦੀ ਬਹੁਤ ਵਧੀਆ ਸਹੂਲਤ ਹੈ ਸਾਨੂੰ